ਪੰਜਾਬੀ ਭਾਸ਼ਾ ਦੇਸ਼ ਦੀ ਇੱਕ ਢੁੱਕਵੀਂ ਭਾਸ਼ਾ ਹੈ ਪੰਜਾਬੀ ਬੋਲੀ ਨਾ ਕਿ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਕਰਕੇ ਪੰਜਾਬੀਆਂ ਦਾ ਮਾਣ ਸਾਰੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹੈ ਇਹ ਭਾਸ਼ਾ ਬਹੁਤ ਮਿੱਠੀ ਹੈ ਅਤੇ ਸਭ ਨੂੰ ਸਮਝਣ ਵਿੱਚ ਸੌਖੀ ਹੈ ਅਤੇ ਵ ਇਹ ਆਕਰਸ਼ਣ ਭਾਸ਼ਾ ਵੀ ਹੈ ਅਸੀਂ ਇਸ ਦੀ ਵਰਤੋਂ ਆਪਣੇ ਵਿਚਾਰ ਵਟਾਂਦਰੇ ਅਤੇ ਆਪਸੀ ਦਿਲਾਂ ਦੀਆਂ ਗੱਲਾਂ ਨੂੰ ਇੱਕ ਦੂਜੇ ਨਾਲ਼ ਸਾਂਝੀਆਂ ਕਰਦੇ ਹਨ ਸਾਨੂੰ ਆਪਣੇ ਆਲ਼ੇ ਦੁਆਲ਼ੇ ਪੰਜਾਬੀ ਭਾਸ਼ਾ ਦਾ ਮਾਹੌਲ ਹਮੇਸ਼ਾ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਸਭ ਪੰਜਾਬੀ ਭਾਸ਼ਾ ਨਾਲ ਜੁੜੇ ਰਹਿ ਸਕਣ ਸਾਨੂੰ ਆਪਣੇ ਘਰਾਂ ਦੇ ਵਿੱਚ ਵੀ ਬੱਚਿਆਂ ਨਾਲ਼ ਪੰਜਾਬੀ ਬੋਲਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਸਾਡੀ ਪੰਜਾਬੀ ਬੋਲੀ ਬਾਰੇ ਪਤਾ ਲੱਗ ਸਕੇ ਅੱਜ ਕੱਲ੍ਹ ਬੱਚੇ ਹਿੰਦੀ ਭਾਸ਼ਾ ਵੱਲ ਅੰਗਰੇਜ਼ੀ ਵੱਲ ਜ਼ਿਆਦਾ ਜਾਣ ਲੱਗ ਪਏ ਹਨ ਪਰ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਘਰਾਂ ਆਪਣੇ ਬੱਚਿਆਂ ਨਾਲ਼ ਪੰਜਾਬੀ ਵਿੱਚ ਗੱਲ ਕਰੀਏ ਉਨ੍ਹਾਂ ਨੂੰ ਪੰਜਾਬੀ ਸਮਝਾਈਏ ਅਤੇ ਪੜ੍ਹਨੀ ਸਿਖਾਈ